ਜੇਕਰ ਆਪਾਂ ਗੱਲ ਕਰਦੇ ਹਾਂ ਕਲਾ ਰੂਪ ਜਾਂ ਸ਼ਿਲਪਕਾਰੀ ਦੇ ਤਾਂ ਸਾਡੇ ਖੇਤਰ ਵਿੱਚ ਜ਼ਿਆਦਾਤਰ ਫੁਲਕਾਰੀਆਂ ਬਾਗਾਂ ਅਤੇ ਟਾਪਟੇ ਦਾ ਬਹੁਤ ਜ਼ਿਆਦਾ ਚਲਣ ਹੈ ਜਿੰਨ੍ਹਾਂ ਵਿੱਚੋਂ ਕਿ ਆਪਾਂ ਦੇਖਦੇ ਹਾਂ ਕਿ ਜੋ ਟਾਪਟਾ ਹੈ ਟਾਪਟੇ ਉੱਤੇ ਲਾਲ ਅਤੇ ਪੀਲੇ ਕਲਰ ਦੀ ਕਢਾਈ ਕੀਤੀ ਜਾਂਦੀ ਹੈ ਅਤੇ ਜੇਕਰ ਆਪਾਂ ਗੱਲ ਕਰਦੇ ਹਾਂ ਬਾਗ ਦੀ ਤਾਂ ਬਾਗ 'ਤੇ ਵੀ ਬਹੁਤ ਹੀ ਜ਼ਿਆਦਾ ਗਹਿਰਾਈ ਨਾਲ ਅਤੇ ਡੂੰਘਾਈ ਨਾਲ ਕਢਾਈ ਕੀਤੀ ਜਾਂਦੀ ਹੈ ਜਿਹਦੇ 'ਤੇ ਲੰਬਾ ਸਮਾਂ ਲੰਬਾ ਸਮਾਂ ਲੱਗਦਾ ਹੈ ਅਤੇ ਉਵੇਂ ਹੀ ਫੁਲਕਾਰੀ ਦਾ ਵੀ ਹੁੰਦਾ ਹੈ ਫੁਲਕਾਰੀ 'ਤੇ ਵੀ ਬਹੁਤ ਜ਼ਿਆਦਾ ਬਰੀਕੀ ਨਾਲ ਕਢਾਈ ਕੀਤੀ ਜਾਂਦੀ ਹੈ ਜੋ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਮਨ ਨੂੰ ਭਾਉਂਦਾ ਹੈ